ਤੈਕਨੋਲਜੀ ਦੀ ਵਰਤੋਂ ਸੰਸਾਰ ਨੇ ਸਾਡੇ ਆਲੇ ਦੁਆਲੇ ਗੱਲਬਾਤ ਕਰਨ ਦੇ ਤਰੀਕੇ ਇਸ ਤਰ੍ਹਾਂ ਬਦਲ ਤੇ ਨੇ ਅੱਜ ਦੇ ਯੁੱਗ ਦੇ ਵਿੱਚ ਮੋਬਾਈਲ ਚੱਲ ਪਏ ਨੇ ਕਈ ਵੈਬਸਾਈਟਸ ਚੱਲ ਪਈਆਂ ਨੇ ਜਿਹਦੇ ਥਰੂ ਅਸੀਂ ਸੋਸ਼ਲ ਮੀਡੀਆ ਰਾਹੀਂ ਆਪਣਿਆਂ ਦੇ ਕੋਲ ਵੀ ਆਏ ਤਾਂ ਦੂਰ ਵੀ ਗਏ ਪਰ ਜਿਸ ਹਿਸਾਬ ਨਾਲ ਕੋਵਿਡ ਚੱਲਿਆ ਤਾਂ ਕੋਵਿਡ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿ ਕਈ ਲੋਕਾਂ ਦੇ ਘਰ ਖਰਾਬ ਹੋਏ ਇੰਨੀ ਬਿਮਾਰੀ ਫੈਲ ਗਈ ਸੀ ਪਰ ਸਾਡਾ ਇਹਨੇ ਤੈਕਨੋਲੋਜੀ ਨੇ ਮੋਬਾਇਲ ਨੇ ਸਾਡਾ ਬਹੁਤ ਸਾਥ ਦਿੱਤਾ ਬੱਚਿਆਂ ਦੀਆਂ ਪੜ੍ਹਾਈਆਂ ਕੋਵਿਡ ਦੇ ਵਿੱਚ ਔਨਲਾਈਨ ਚੱਲੀਆਂ ਔਨਲਾਈਨ ਟੀਚਰਾਂ ਨੇ ਕਲਾਸਾਂ ਲਗਾਈਆਂ ਕਿ ਤਾਂ ਕਿ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਮੰਨ ਲਓ ਜਾਂ ਕਿਸੇ ਦੇ ਘਰ 'ਚ ਕਿਸੇ ਦੀ ਮੌਤ ਹੋ ਗਈ ਜਾਂ ਆਪਣੇ ਵੱਲ ਆਉਣਾ ਜਾਣਾ ਲੋਕਾਂ ਦਾ ਬੰਦ ਹੋ ਗਿਆ ਕੋਈ ਕੰਮ ਜਿਹੜਾ ਅਸੀਂ ਜਾ ਆ ਕੇ ਨਹੀਂ ਕਰ ਸਕਦੇ ਸੀ ਉਹ ਮੋਬਾਈਲ ਦੇ ਰਾਹੀਂ ਹੀ ਸਾਡਾ ਹੋਇਆ ਅੱਜ ਦੀ ਟੈਕਨੋਲੋਜੀ ਨੇ ਸਾਨੂੰ ਬਹੁਤ ਨੇੜੇ ਲਿਆਉਂਦਾ ਕਈ ਰਿਸ਼ਤੇ ਸਾਡੇ ਦੂਰ ਹੋ ਚੁੱਕੇ ਸਨ ਵਿਛੜ ਗਏ ਸਨ ਪਰ ਸਾਨੂੰ ਇਸ ਟੈਕਨੋਲੋਜੀ ਨੇ ਜਾਂ ਮੰਨ ਲਓ ਇਸ ਮੋਬਾਈਲ ਨੇ ਸੋਸ਼ਲ ਮੀਡੀਆ ਰਾਹੀਂ ਫੇਸਬੁੱਕ ਹੈ ਵਾਟਸਐਪ ਹੈ ਜਾਂ ਕਈ ਵੀ ਵੈਬਸਾਈਟਸ ਨੇ ਇਹਨੇ ਸਾਨੂੰ ਆਪਣਿਆਂ ਤੋਂ ਕੋਲ ਬਹੁਤ ਲਿਆਉਂਦਾ ਕੋਈ ਦੁੱਖ ਹੋਵੇ ਜਾਂ ਸੁੱਖ ਹੋਵੇ ਇੱਕ ਮਿਨਟ ਦਾ ਪਤਾ ਲੱਗ ਜਾਂਦਾ ਹੈ ਜਾਂ ਕੋਈ ਗਿਆ ਏ ਲੇਟ ਆਇਆ ਜਾਂ ਨਹੀਂ ਆਇਆ ਲੇਟ ਸਵੇਰ ਹੋ ਰਿਹਾ ਸਾਨੂੰ ਮਿੰਟ ਮਿੰਟ ਦੀ ਮਤਲਬ ਕਿ ਪਤਾ ਲੱਗਦਾ ਰਹਿੰਦਾ ਹੈ ਕਿ ਕੀ ਗੱਲ ਹੈ ਕੀ ਮੁਸ਼ਕਿਲ ਹੈ ਕੋਈ ਮੁਸ਼ਕਿਲ ਦੇ ਵਿੱਚ ਵੀ ਹੈ ਅਤੇ ਇਹ ਚੀਜ਼ ਸਾਨੂੰ ਬਹੁਤ ਕਦਮ ਕਦਮ 'ਤੇ ਸਾਥ ਦਿੰਦੀ ਹੈ ਇਸ ਕਰਕੇ ਤੈਕਨੋਲੋਜੀ ਦੀ ਵਰਤੋਂ ਸਾਡੀ ਜ਼ਰੂਰਤ ਬਣ ਚੁੱਕੀ ਹੈ ਜਿਹਦੇ ਬਿਨਾਂ ਅਸੀਂ ਨਹੀਂ ਰਹਿ ਸਕਦੇ